ਹਾਂ ਮੇਰੇ ਕੋਲ ਪਸ਼ੂ ਹਨ ਅਤੇ ਕੁਝ ਨਵੇਂ ਜੰਮੇ ਪਸ਼ੂ ਵੀ ਹਨ ਅਤੇ ਮੈਂ ਉਹਨਾਂ ਦੀ ਦੇਖਭਾਲ ਬਹੁਤ ਹੀ ਵਧੀਆ ਤਰੀਕੇ ਨਾਲ ਕਰਦਾ ਹਾਂ ਮੈਂ ਉਹਨਾਂ ਨੂੰ ਸਹੀ ਤਰੀਕੇ ਨਾਲ ਦੇਖਣਾ ਪਾਣੀ ਪਿਲਾਉਣਾ ਦੇਖ ਰੇਖ ਕਰਨੀ ਅਤੇ ਸਾਰੇ ਕੰਮ ਬੜੇ ਹੀ ਧਿਆਨ ਅਤੇ ਤਰੀਕੇ ਨਾਲ ਕਰਦਾ ਹਾਂ ਗਰਮੀ ਵਿੱਚ ਪਸ਼ੂਆਂ ਦੀ ਸੰਭਾਲ ਕਰਨ ਦੇ ਵੱਖੋ ਵੱਖਰੇ ਤਰੀਕੇ ਹਨ ਅਤੇ ਸਰਦੀਆਂ ਵਿੱਚ ਪਸ਼ੂਆਂ ਦੀ ਧਿਆਨ ਰੱਖਣ ਦੇ ਵੀ ਵੱਖੋ ਵੱਖਰੇ ਤਰੀਕੇ ਹਨ ਗਰਮੀਆਂ ਵਿੱਚ ਪਸ਼ੂਆਂ ਨੂੰ ਠੰਡਾ ਪਾਣੀ ਸਹੀ ਅਹਾਰ ਸਹੀ ਸਾਂਭ ਸੰਭਾਲ ਕਰਨੀ ਇਹ ਸਾਰੇ ਕੰਮ ਨਵੇਂ ਜੰਮੇ ਪਸ਼ੂ ਅਤੇ ਆਪਣੇ ਪਸ਼ੂਆਂ ਦੀ ਦੇਖ ਰੇਖ ਵਿੱਚ ਆ ਜਾਂਦੇ ਹਨ ਠੰਡ ਵਿੱਚ ਪਸ਼ੂਆਂ ਦੀ ਸੰਭਾਲ ਵੱਖੋ ਵੱਖਰੇ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਅਤੇ ਮੈਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਮੇਂ 'ਤੇ ਟੀਕੇ ਵੀ ਲਗਵਾਉਂਦਾ ਰਹਿੰਦਾ ਹਾਂ ਅਤੇ ਸਮੇਂ ਸਮੇਂ 'ਤੇ ਡਾਕਟਰਾਂ ਤੋਂ ਜਾਂਚ ਵੀ ਕਰਵਾਉਂਦਾ ਹਾਂ ਤਾਂ ਜੋ ਉਹਨਾਂ ਨੂੰ ਕੋਈ ਵੀ ਬਿਮਾਰੀ ਨਾ ਲੱਗੇ ਦਵਾਈਆਂ ਦੇਣ ਤੋਂ ਲੈ ਕੇ ਪਸ਼ੂਆਂ ਦੀ ਸਾਂਭ ਸੰਭਾਲ ਤੱਕ ਸਾਰਾ ਕੰਮ ਮੈਂ ਖੁਦ ਕਰਦਾ ਹਾਂ ਸਮੇਂ ਸਮੇਂ 'ਤੇ ਉਹਨਾਂ ਨੂੰ ਪਸ਼ੂ ਖੁਰਾਕ ਅਤੇ ਸਹੀ ਅਹਾਰ ਵੀ ਦਿੰਦਾ ਹਾਂ ਤਾਂ ਜੋ ਉਹਨਾਂ ਦੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹੀ ਅਹਾਰ ਅਤੇ ਭੋਜਨ ਮਿਲਦਾ ਰਹੇ ਨਵੇਂ ਜੰਮੇ ਪਸ਼ੂ ਦੀ ਦਾ ਧਿਆਨ ਬਿਲਕੁਲ ਸਹੀ ਤਰੀਕੇ ਨਾਲ ਕਰਨਾ ਪੈਂਦਾ ਹੈ ਕਿਉਂਕਿ ਉਹ ਪਸ਼ੂ ਬਿਲਕੁਲ ਨਵਾਂ ਜੰਮਿਆ ਹੁੰਦਾ ਹੈ ਇਸਦੇ ਕਾਰਨ ਉਹਦੇ ਵਿੱਚ ਬਿਲਕੁਲ ਜਾਨ ਵੀ ਨਹੀਂ ਹੁੰਦੀ ਤਾਂ ਜੋ ਕੁਝ ਖਾ ਪਿਲਾ ਸਕੇ ਉਹਨੂੰ ਸਹੀ ਸਮੇਂ 'ਤੇ ਦਵਾਈ ਟੀਕਾਕਰਨ ਅਤੇ ਡਾਕਟਰ ਦੀ ਦੇਖ ਰੇਖ ਵਿੱਚ ਵੀ ਉਸਨੂੰ ਦਿਖਾਉਣਾ ਚਾਹੀਦਾ ਹੈ ਪਸ਼ੂਆਂ ਨੂੰ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਾਂਗੇ ਉਦੋਂ ਹੀ ਉਹ ਸਾਨੂੰ ਸਹੀ ਮਾਤਰਾ ਵਿੱਚ ਦੁੱਧ ਅਤੇ ਵਧੀਆ ਅਹਾਰ ਵੀ ਪ੍ਰਦਾਨ ਕਰਨਗੇ